ਹੈਲੋ ਜੀ ਟਰੈਵਲ ਏਜੰਸੀ ਤੋਂ ਬੋਲ ਰਹੇ ਜੀ ਮੈਂ ਜੀ ਕੈਬ ਬੁੱਕ ਕੀਤੀ ਸੀ ਜੀ ਵੀਹ ਤਰੀਕ ਵਾਸਤੇ ਚੰਡੀਗੜ੍ਹ ਜਾਣ ਲਈ ਲੇਕਿਨ ਮੇਰੀ ਮੀਟਿੰਗ ਕੈਂਸਲ ਹੋ ਗਈ ਹੈ ਜੀ ਮੈਂ ਕੁਛ ਡਰਾਈਵਰ ਨੂੰ ਐਡਵਾਂਸ ਪੇਮੈਂਟ ਦਿੱਤੀ ਸੀ ਉਹ ਮੇਰੀ ਰਿਫੰਡ ਹੋ ਸਕਦੀ ਹੈ ਜੀ